ਜਦੋਂ ਅਸੀਂ ਕਦੇ ਵੀ ਕਿਸੇ ਥਾਂ 'ਤੇ ਜਾਣਾ ਹੋਵੇ ਤਾਂ ਸਭ ਤੋਂ ਪਹਿਲਾਂ ਅਸੀਂ ਮੌਸਮ ਬਾਰੇ ਜਾਣਕਾਰੀ ਲੈਂਦੇ ਲੈਂਦੇ ਹਾਂ ਮੌਸਮ ਬਾਰੇ ਜਾਣਕਾਰੀ ਲੈਣ ਵਾਸਤੇ ਇੰਟਰਨੈੱਟ ਜ਼ਰੀਆ ਬਹੁਤ ਵਧੀਆ ਹੈ ਇਸ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮੌਸਮ ਕਿਸ ਤਰਾਂ ਦਾ ਹੈ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਂਦਾ ਹੈ ਉਸੇ ਤਰਾਂ ਹੀ ਸਰਫਿੰਗ ਕਰਨ ਤੋਂ ਪਹਿਲਾਂ ਮੌਸਮ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੁੰਦਾ ਹੈ